ਪੰਜਾਬ ਵਿੱਚ ਕਾਫ਼ੀ ਤਰ੍ਹਾਂ ਦੀਆਂ ਖੇਡਾਂ ਪ੍ਰਸਿੱਧ ਹਨ ਖਾਸ ਤੌਰ ਉੱਤੇ ਕਬੱਡੀ ਹੋਕੀ ਜਿਹੀਆਂ ਗੇਮਾਂ ਖੇਡਾਂ ਕਾਫ਼ੀ ਪ੍ਰਸਿੱਧ ਹਨ ਇਨ੍ਹਾਂ ਵਿੱਚ ਬਹੁਤ ਪੰਜਾਬੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਇਹ ਖੇਡਾਂ ਮੇਲਿਆਂ ਵਿੱਚ ਇਹਨਾਂ ਖੇਡਾਂ ਦੇ ਅਖਾੜੇ ਲੱਗਦੇ ਹਨ ਜਿਹਦੇ ਵਿੱਚ ਪੰਜਾਬੀ ਮੁਕਾਬਲਾ ਕਰਾਉਂਦੇ ਹਨ ਅਤੇ ਲੋਕ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਜਿਨ੍ਹਾਂ ਵਿੱਚ ਸੈਲਾਨੀ ਪੰਜਾਬ ਦੇ ਵਿੱਚ ਆਉਣ ਵਾਲੇ ਹਿੱਸਾ ਲੈ ਸਕਦੇ ਹੈ ਹਰ ਸਾਲ ਹਰ ਧਰਮ 'ਤੇ ਵੱਖ ਵੱਖ ਜਗ੍ਹਾਵਾਂ 'ਤੇ ਮੇਲੇ ਲੱਗਦੇ ਹਨ ਜਿਨ੍ਹਾਂ ਵਿੱਚ ਇਹ ਖੇਡਾਂ ਪ੍ਰਸਿੱਧ ਰੂਪ 'ਤੇ ਖੇਡੀਆਂ ਜਾਂਦੀਆਂ ਹਨ ਲੋਕਾਂ ਦਾ ਇਨ੍ਹਾਂ ਖੇਡਾਂ ਵਿੱਚ ਕਾਫ਼ੀ ਰੁਝਾਨ ਦੇਖਿਆ ਜਾ ਸਕਦਾ ਹੈ ਜਿਵੇਂ ਕਿ ਕੁਸ਼ਤੀ ਲੜਨ ਲਈ ਮੁੰਡਿਆਂ ਵਿੱਚ ਬਹੁਤ ਹੀ ਜ਼ਿਆਦਾ ਜੋਸ਼ ਦੇਖਿਆ ਜਾ ਸਕਦਾ ਹੈ ਅਤੇ ਜੇ ਬਾਹਰਲੀ ਖੇਡਾਂ ਦੀ ਗੱਲ ਕਰੀਏ ਅਤੇ ਹਾਈਕਿੰਗ ਟ੍ਰੈਕਿੰਗ ਅਤੇ ਹੋਰ ਵੀ ਨਵੇਂ ਜ਼ਮਾਨੇ ਦੀਆਂ ਖੇਡਾਂ ਹਨ ਹੈਕ ਹਾਈਕਿੰਗ ਅਤੇ ਟ੍ਰੈਕਿੰਗ ਅੱਜ ਦੇ ਜ਼ਮਾਨੇ ਦੀ ਅੱਜ ਦੀ ਪੀੜ੍ਹੀ ਦੀ ਪ੍ਰਸਿੱਧ ਖੇਡ ਕਹਿ ਲਉ ਜਾਂ ਮਨੋਰੰਜਨ ਦਾ ਸਾਧਨ ਬਣ ਚੁੱਕੀ ਹੈ